ਤੁਸੀਂ ਜ਼ਿੰਦਗੀ ਵਿੱਚ ਕਿਹੜੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਅਤੇ ਬਚਪਨ ਦੇ ਵਿੱਚ ਮਾਤਾ ਗੁਜ਼ਰ ਦੇ ਗੁਜ਼ਰ ਕਾਰਨ ਅਤੇ ਸਾਨੂੰ ਆਪਣੇ ਆਪ ਸਾਰਾ ਪਰਵਰਿਸ਼ ਆਪ ਕਰਨੀ ਪੈਂਦੀ ਸੀ ਅਤੇ ਉਸ ਤੋਂ ਬਾਅਦ ਤਿਆਰ ਹੋ ਕੇ ਜਾਣਾ ਸਕੂਲ ਨੂੰ ਅਤੇ ਸਕੂਲ ਜਾਣਾ ਪੈਂਦਾ ਸੀ ਅਤੇ ਉਸ ਤੋਂ ਬਾਅਦ ਫਿਰ ਵ ਵੱਡੇ ਹੋ ਗਏ ਅਤੇ ਮਾੜਾ ਮੋਟਾ ਅਸੀਂ ਆਪਣਾ ਘਰ ਘਰ ਦਾ ਵੀ ਆ ਕੇ ਕੰਮ ਕਰਨਾ ਤਾ ਦੋ ਭੈਣਾਂ ਹੁੰਦੀਆਂ ਸੀ ਅਤੇ ਉਹ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੁੰਦੀ ਸੀ ਅਤੇ ਜਿੱਥੇ ਜਾਣਾ ਆਉਣਾ ਅਤੇ ਦਵਾਈ ਮਾਤਾ ਪਿਤਾ ਪਿਤਾ ਜੀ ਬਜ਼ੁਰਗ ਹੁੰਦੇ ਸੀ ਅਤੇ ਉਸ ਨੂੰ ਦਵਾਈ ਲੈ ਕੇ ਵੀ ਆਉਣ ਆਉਣੀ ਪੈਂਦੀ ਸੀ ਅਤੇ ਉਹ ਤੋਂ ਬਾਅਦ ਅਸੀਂ ਬਾਹਰ ਦਾ ਕੰਮ ਵੀ ਕਰ ਕਰਦੇ ਕਰਦੇ ਹੁੰਦੇ ਸੀ ਬਾਹਰ ਬਾਹਰ ਦਾ ਕੰਮ ਵੀ ਕਰਦੇ ਹੁੰਦੇ ਸੀ ਅਤੇ ਘਰ ਦਾ ਕੰਮ ਵੀ ਕਰਨਾ ਪੈਂਦਾ ਤਾ ਅਤੇ ਫਿਰ ਸਾਨੂੰ ਜਾਣਾ ਪੈ ਗਿਆ ਅਤੇ ਉੱਥੇ ਅਸੀਂ ਆਪਣਾ ਮੁਸ਼ਕਲ ਦੇ ਨਾਲ ਬਹੁਤ ਉਹ ਗੁਜ਼ਾਰਾ ਗੁਜ਼ਾਰਾ ਵੀ ਅਤੇ ਰੋਟੀ ਪਾਣੀ ਦਾ ਵੀ ਸਾਨੂੰ ਬਹੁਤ ਔਖਾ ਹੁੰਦਾ ਤਾ ਅਤੇ ਰੋਟੀ ਪਾਣੀ ਦੇ ਬਾਅਦ ਅਸੀਂ ਕਿਤੇ ਬਾਹਰ ਕਿਸ ਦੇ ਕਿਸੇ ਦੇ ਘਰ ਜਾ ਕੇ ਕੰਮ ਕਰਨਾ ਪੈਂਦਾ ਅਤੇ ਉਸ ਤੋਂ ਬਾਅਦ ਫਿਰ ਸਾਨੂੰ ਘਰ ਵੀ ਕਰਨਾ ਪੈਂਦਾ ਤਾ ਸਕੂਲ ਵੀ ਜਾਣਾ ਪੈਂਦਾ ਸੀ ਅਤੇ ਉਤ ਅਤੇ ਵੱਡੇ ਹੋ ਕੇ ਸਾਨੂੰ ਕਿਤੇ ਦਿਹਾੜੀ ਜੋਤੇ 'ਤੇ ਵੀ ਕਰਨ ਜਾਣਾ ਪੈਂਦਾ ਤਾ ਦਿਹਾੜੀ ਜੋਤੇ ਦੇ ਵਿੱਚ ਉਹ ਵੀ ਅਸੀਂ ਆਪਣਾ ਕਮਾ ਕੇ ਕਦੇ ਮਿਸਤਰੀ ਗੈਲ ਜਾਣਾ ਹੁੰਦਾ ਤਾ ਕਦੇ ਫੈਕਟਰੀ 'ਚ ਜਾਂਦੇ ਤੇ ਅਤੇ ਅਸੀਂ ਮਾੜੀ ਮੋਟੀ ਜੋ ਵੀ ਤੇ ਹੁੰਦੀ ਤੀ ਸਾਰੀ ਆਪਣਾ ਗੁਜ਼ਾਰਾ ਘਰ ਦਾ ਬਹੁਤ ਔਖਾ ਹੈ ਮੁਸ਼ਕਲ ਹੈ ਤਾ ਕਰਨਾ ਪੈਂਦਾ ਵਾ ਅਤੇ ਬਹੁਤ ਸੰਘਰਸ਼ ਕੀਤਾ ਜ਼ਿੰਦਗੀ ਦੇ ਵਿੱਚ